ਮੈਂ ਪੰਜਾਬ ਦੀ ਵਸਨੀਕ ਹਾਂ ਮੈਂ ਸ਼ੁਰੂ ਤੋਂ ਪੰਜਾਬੀ ਹੀ ਬੋਲਦੀ ਹਾਂ ਜਿੱਦਾਂ ਕਿ ਘਰ ਵਿੱਚ ਬਚਪਨ ਤੋਂ ਲੈ ਕੇ ਹੁਣ ਤੱਕ ਪੰਜਾਬੀ ਹੀ ਬੋਲੀ ਜਾਂਦੀ ਹੈ ਇਸ ਕਰਕੇ ਮੈਨੂੰ ਪੰਜਾਬੀ ਮੇਰੇ ਪਰਿਵਾਰ ਤੋਂ ਹੀ ਸਿੱਖਣ ਲਈ ਮਿਲੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਲਈ ਮੈਨੂੰ ਪੰਜਾਬੀ ਬੋਲਣ ਉੱਤੇ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਅਸੀਂ ਜਿਸ ਖੇਤਰ ਵਿੱਚ ਵੀ ਜਾ ਕੇ ਗੱਲ ਕਰਦੇ ਹਾਂ ਤਾਂ ਸਾਡੀ ਭਾਸ਼ਾ ਤੋਂ ਹੀ ਅਗਲੇ ਨੂੰ ਅਨੁਭਵ ਹੋ ਜਾਂਦਾ ਹੈ ਕਿ ਇਹ ਪੰਜਾਬ ਤੋਂ ਆਏ ਹਨ ਮੈਨੂੰ ਪੰਜਾਬੀ ਹੋਣ ਅਤੇ ਪੰਜਾਬੀ ਬੋਲਣ ਉੱਤੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ